ਪੰਜ ਜਨਵਰੀ ਦੋ ਹਜ਼ਾਰ ਪੰਦਰ੍ਹਾਂ ਗਿਆਰ੍ਹਾਂ ਫਰਵਰੀ ਦੋ ਹਜ਼ਾਰ ਸੌਲ੍ਹਾਂ ਅਠਾਰ੍ਹਾਂ ਮਾਰਚ ਦੋ ਹਜ਼ਾਰ ਅਠਾਰ੍ਹਾਂ ਅਠਾਈ ਫਰਵਰੀ ਦੋ ਹਜ਼ਾਰ ਵੀਹ ਪੰਦਰ੍ਹਾਂ ਅਗਸਤ ਦੋ ਹਜ਼ਾਰ ਇੱਕੀ